ਅੱਜ ਕੱਲ੍ਹ ਦੇ ਸਮਾਜ ਵਿੱਚ ਚੁਣੌਤੀ ਹੀ ਸ਼ ਚੁਣੌਤੀਆਂ ਹਨ ਔਰਤਾਂ ਵਕੀਲ ਡਾਕਟਰ ਇੰਜੀਨੀਅਰ ਬਣਦੀਆਂ ਹਨ ਅਤੇ ਸਰਕਾਰ ਵੀ ਵੈਸੇ ਹੀ ਔਰਤਾਂ ਲਈ ਚੰਗੇ ਕਾਨੂੰਨ ਲਿਆ ਰਹੀ ਹੈ ਅਤੇ ਵੈਸੇ ਇੱਕ ਔਰਤ ਨੂੰ ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ ਹੋਵੇ ਇਕੱਲੇ ਨੂੰ ਤਾਂ ਮੁਸ਼ਕਿਲ ਹੀ ਹੈ ਕੋਈ ਨਾ ਕੋਈ ਪਰਿਵਾਰ ਦਾ ਕੋਈ ਨਾਲ਼ ਮੈਂਬਰ ਤਾਂ ਜਾਂਦਾ ਹੀ ਹੈ ਅਤੇ ਇਸ ਦਾ ਉਲਟ ਜਿਹੜੇ ਵੱਡੇ ਸ਼ਹਿਰ ਹੈਗੇ ਆ ਉਹ ਰਾਤ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਆਸਾਨੀ ਨਾਲ਼ ਚਲੇ ਜਾਂਦੇ ਹਨ ਕਿਉਂਕਿ ਟਰਾਂਸਪੋਰਟ ਦੇ ਸਾਧਨ ਉਪਲਬਧ ਹੈਗੇ ਹੈ ਅਤੇ ਵੈਸੇ ਵੀ ਅੱਜ ਕੱਲ੍ਹ ਸਾਰਿਆਂ ਕੋਲ ਮੋਬਾਇਲ ਹੁੰਦੇ ਹੀ ਹਨ ਅਤੇ ਜਦੋਂ ਕੋਈ ਸਹਾਇਤਾ ਲੈਣੀ ਹੋਵੇ ਤਾਂ ਉਹ ਸਹਾਇਤਾ ਮਿਲ ਵੀ ਸਕਦੀ ਹੈਗੀ ਹੈ ਅਤੇ ਦੂਸ ਦੂਸਰੇ ਨੰਬਰ 'ਤੇ ਜਿਹੜੇ ਸਿਕਸ਼ਾ ਵਿੱਚ ਤਾਂ ਬਰਾਬਰ ਮੌਕੇ ਮਿਲਦੇ ਹੀ ਹਨ ਹੁਣ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ ਔਰਤਾਂ ਲਈ ਅਤੇ ਵੈਸੇ ਵੀ ਕੁਝ ਸਰਕਾਰਾਂ ਹੈਗੀਆਂ ਉਹ ਸਿੱਖਿਆ ਵਿੱਚ ਪੰਜਾਹ ਪਰਸੈਂਟ ਸੀਟਾਂ ਉਹ ਔਰਤਾਂ ਲਈ ਰਾਖਵੀਆਂ ਰੱਖਦੀਆਂ ਹਨ ਅਤੇ ਉਹਦੇ ਨਾਲ਼ ਕੀ ਹੁੰਦਾ ਹੈ ਕਿ ਵੱਧ ਤੋਂ ਵੱਧ ਔਰਤਾਂ ਪੜ੍ਹ ਜਾਂਦੀਆਂ ਹਨ ਅਤੇ ਸਮਾਜ 'ਚ ਮੋਢੇ ਨਾਲ਼ ਮੋਢੇ ਮਿਲਾ ਕੇ ਚੱਲਦੀਆਂ ਹਨ